ਜੇਕਰ ਖੇਤੀਬਾੜੀ ਦੇ ਪੱਖ ਤੋਂ ਦੇਖੀਏ ਤਾਂ ਜਿਹੜਾ ਮੋਹਾਲੀ ਜ਼ਿਲ੍ਹਾ ਇਹ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਨਾਲ਼ ਸੰਬੰਧਿਤ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਭਾਵੇਂ ਫ਼ਸਲਾਂ ਦਾ ਹੋਵੇ ਭਾਵੇਂ ਪਸ਼ੂਆਂ ਦਾ ਹੋਵੇ ਭਾਵੇਂ ਫ਼ਸਲਾਂ ਦੀ ਸਿੰਚਾਈ ਦਾ ਹੋਵੇ ਭਾਵੇਂ ਖੇਤੀਬਾੜੀ ਕਰਨ ਲਈ ਨਵੀਂ ਤਕਨੀਕ ਨਵੀਂ ਤਕਨੋਲਜੀ ਹੁਣ ਜੇਕਰ ਫ਼ਸਲਾਂ ਦੀ ਗੱਲ ਕਰੀਏ ਤਾਂ ਇੱਥੇ ਕਣਕ ਜ਼ੀਰੀ ਅਤੇ ਹੋਰ ਰਵਾਇਤੀ ਫ਼ਸਲਾਂ ਨੇ ਉਹਨਾਂ ਦੀ ਖੇਤੀ ਕੀਤੀ ਜਾਂਦੀ ਹੈ ਇੱਥੇ ਜਿਹੜਾ ਮੋਹਾਲੀ ਏ ਇਹ ਬਹੁਤ ਸ਼ਹਿਰੀ ਏਰੀਆ ਪਰ ਇਹਦੇ ਜਿਹੜੇ ਆਲ਼ੇ ਦੁਆਲੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਨਵੀਂ ਟਕਨੋਲਜੀ ਦੇ ਮੁਤਾਬਿਕ ਜਿਹੜਾ ਸੈਂਟਰ ਖੋਲ੍ਹੇ ਗਏ ਨੇ ਲੋਕਾਂ ਨੂੰ ਫ਼ਸਲਾਂ ਦੀ ਜਿਹੜੀ ਪੈਦਾਵਾਰ ਹੈ ਉਹ ਵਧਾਉਣ ਦੇ ਲਈ ਜਾਂ ਨਵੀਂ ਤਕਨੀਕ ਦੇ ਨਾਲ਼ ਖੇਤੀਬਾੜੀ ਕਰਨ ਲਈ ਉਹਨਾਂ ਨੂੰ ਤਕਨੀਕ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਪਸ਼ੂਆਂ ਦੇ ਲਈ ਵੀ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਿਹੜੇ ਸੈਂਟਰ ਖੋਲ੍ਹੇ ਗਏ ਨੇ ਜਿਹਦੇ ਵਿੱਚ ਪਸ਼ੂਆਂ ਦੀ ਸੰਭਾਲ ਉਹਨਾਂ ਨੂੰ ਜੋ ਖਾਣ ਪੀਣ ਦਾ ਹਰੇ ਚਾਰੇ ਦਾ ਪ੍ਰਬੰਧ ਹੈ ਉਹ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਆਪਾਂ ਉਹਨਾਂ ਦੀ ਸਿਹਤ ਦੇ ਲਈ ਕੋਈ ਕੋਈ ਪ੍ਰੋਡਕਟ ਜਿਹੜਾ ਹੈਗਾ ਉਹ ਆਪਾਂ ਵਰਤ ਸਕਦੇ ਹਾਂ ਤਾਂ ਜੋ ਜਿਹੜੇ ਦੁਧਾਰੂ ਪਸ਼ੂ ਨੇ ਵੀ ਉਹ ਤੰਦਰੁਸਤ ਵੀ ਰਹਿਣ ਅਤੇ ਉਹਨਾਂ ਤੋਂ ਜਿਹੜਾ ਦੁੱਧ ਦੀ ਪੈਦਾਵਾਰ ਉਹ ਵਧੇ ਸੋ ਖੇਤੀਬਾੜੀ ਦੇ ਜਿਹੜਾ ਸਰਕਲ ਦੇ ਵਿੱਚ ਜਿਹੜਾ ਮੋਹਾਲੀ ਜ਼ਿਲ੍ਹਾ ਉਹ ਬਹੁਤ ਅਹਿਮ ਆਪਣੀ ਭੂਮਿਕਾ ਨਿਭਾ ਰਿਹਾ